ਭੰਗੜੇ ਦੇ ਸਟੈਪ ਹਨ ਲੁੱਡੀ ਝੂਮਰ ਸਿੰਗਲ ਭੰਗੜਾ ਸੰਮੀ ਆਦਿ ਅਤੇ ਇਹ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਹਨ ਇਹ ਪੰਜਾਬੀਆਂ ਦੀ ਸ਼ਾਨ ਨੂੰ ਵਧਾਉਂਦੇ ਹਨ ਜਿੱਥੇ ਭੰਗੜਾ ਨਾ ਹੋਏ ਉੱਥੇ ਕਿਸੀ ਵੀ ਪ੍ਰੋਗਰਾਮ ਦਾ ਕੋਈ ਮਜ਼ਾ ਨਹੀਂ ਹੁੰਦਾ ਭੰਗੜਾ ਹੀ ਹਰ ਪ੍ਰੋਗਰਾਮ ਦੀ ਸ਼ਾਨ ਹਨ